ਪੰਜਾਬੀ ਭਾਸ਼ਾ ਦੇ ਸਾਡੇ ਕਲਚਰ ਨੂੰ ਵੀ ਪਛਾਣ ਬਣਾਈ ਹੈ ਪੰਜਾਬੀ ਭਾਸ਼ਾ ਸਭ ਤੋਂ ਸੌਖੀ ਭਾਸ਼ਾ ਹੈ ਅਤੇ ਇਸ ਨੇ ਬੜੀ ਛੇ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ ਇਸਦੇ ਇਸਦੀ ਇਸ ਤੋਂ ਸਾਨੂੰ ਹੋਰ ਬੜਾ ਆਪਣੇ ਕਾਫੀ ਇਹਦੀਆਂ ਗਾਂਹ ਜਿੱਦਾਂ ਮਾਝਾ ਮਾਲਵਾ ਅਤੇ ਦੁਆਬਾ ਅਤੇ ਹਰ ਹਰ ਹਰ ਹਰ ਹਰ ਹਰ ਜੋਨ ਵਿੱਚ ਇਹਨਾਂ ਦੀ ਪ ਇਹਨਾਂ ਦੀ ਪਛਾਣ ਵੱਖਰੀ ਹੈ ਅਤੇ ਬੋਲੀ ਵਿੱਚ ਵੀ ਥੋੜ੍ਹਾ ਫਰਕ ਹੈ ਅਤੇ ਹ ਹਰ ਕੋਈ ਆਪਣੀ ਆਪਣੇ ਆਪਣੇ ਇਲਾਕੇ ਦੀ ਆਪ ਇਲਾਕੇ ਦੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਪੂ ਪੂਰਾ ਸਨਮਾਨ ਦਿੰਦਾ ਹੈ ਅਤੇ ਉਹਨਾਂ ਨੂੰ ਅਤੇ ਸਾਡੇ ਪਛਾਣ ਨੂੰ ਵੀ ਪ੍ਰਭਾਵਿਤ ਕਰਦੀ ਹੈ